ਪੰਜਾਬ ਵਿੱਚ ਮਨੋਰੰਜਨ ਦੇ ਕਈ ਸਾਧਨ ਹਨ ਜੋ ਪੰਜਾਬੀਆਂ ਨੂੰ ਜੀਵਨ ਸ਼ੈਲੀ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ ਇਹਨਾਂ ਤੌਰ 'ਤੇ ਮ ਮਨੋਰੰਜਨ ਦੇ ਤੌਰ 'ਤੇ ਮੁੱਖ ਜ਼ਿਲ੍ਹੇ ਜਾਂ ਕੇਂਦਰਾਂ ਦੀ ਕਾਫੀ ਲੰਮੀ ਸੂਚੀ ਹੈ ਅਤੇ ਇਹਨਾਂ ਵਿੱਚ ਪੰਜਾਬ ਵਿੱਚ ਕਈ ਤਰ੍ਹਾਂ ਦੇ ਸ਼ੋਪਿੰਗ ਮਾਲ ਕਈ ਜ਼ਿਲ੍ਹਿਆਂ ਵਿੱਚ ਸ਼ੋਪਿੰਗ ਮਾਲ ਰੈਸਟੋਰੈਂਟ ਪੱਬ ਅਤੇ ਕਲੱਬ ਆਦਿ ਉਪਲਬਧ ਹਨ ਜਿਵੇਂ ਕਿ ਲੁਧਿਆਣਾ ਇਹਨਾਂ ਵਿੱਚੋਂ ਮੁ ਮੁੱਖ ਜ਼ਿਲ੍ਹੇ ਆਏ ਹਨ ਲੁਧਿਆਣਾ ਜਲੰਧਰ ਮੋਹਾਲੀ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਵੀ ਇਹਨਾਂ ਜ਼ਿਲ੍ਹਿਆਂ ਵਿੱਚ ਸ਼ਾਮਿਲ ਹੈ ਇਹ ਇਹ ਪੰਜਾਬ ਵਿੱਚ ਵੇਖਿਆ ਜਾਵੇ ਤਾਂ ਜਲੰਧਰ ਵਿੱਚ ਆਬੀਵਾ ਮੋਲ ਹੈ ਜੋ ਕਿ ਅਤੇ ਇਸ ਤੋਂ ਇਲਾਵਾ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਵੀ ਕਾਫੀ ਸਾਰੇ ਮੋ ਮੋਲ ਹਨ ਲੁਧਿਆਣਾ ਵਿੱਚ ਵੀ ਕਾਫੀ ਸਾਰੇ ਮੋਲ ਹਨ ਅਤੇ ਪੱਬ ਕਈ ਤਰ੍ਹਾਂ ਦੇ ਪੱਬ ਕਲੱਬ ਹਨ ਜਿਹਨਾਂ ਵਿੱਚ ਜਾ ਕੇ ਲੋਕ ਖਾਣਾ ਰੈਸਟੋਰੈਂਟਾਂ ਵਿੱਚ ਖਾਣਾ ਪਸੰਦ ਕਰਦੇ ਨੇ ਪੱਬਾਂ ਵਿੱਚ ਪਾਰਟੀਆਂ ਅਤੇ ਕਲੱਬਾਂ ਵਿੱਚ ਪਾਰਟੀਆਂ ਵੀ ਕਾਫੀ ਕਰਦੇ ਹਨ